ਭਾਰਤ ਦੇ ਇਤਿਹਾਸ ਨੂੰ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ ਇਸਦਾ ਇਤਿਹਾ ਇਸਦਾ ਇੱਕ ਪਾਸਾ ਤਾਂ ਬਹੁਤ ਹੀ ਮਾਣਯੋਗ ਹੈ ਅਤੇ ਦੂਸਰੇ ਪਾਸੇ ਬਹੁਤ ਹੀ ਦਰਦਨਾਕ ਘਟਨਾ ਹੈ ਇ ਜਿੱਥੇ ਇਸ ਭਾਰਤ ਵਿੱਚ ਸਭ ਤੋਂ ਜ਼ਿਆਦਾ ਮਾਣਯੋਗ ਵਾਲਾ ਦਿਨ ਉਸ ਦਿਨ ਸੀ ਜਿਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਭਾਰਤ ਦਾ ਸੰਵਿਧਾਨ ਛੱਬੀ ਜਨਵਰੀ ਉੱਨੀ ਸੌ ਪੰਜਾਹ ਵਿੱਚ ਲਾਗੂ ਹੋਇਆ ਹੈ ਇਹ ਸੰਵਿਧਾਨ ਡਾਕਟਰ ਡਾਕਟਰ ਅੰਬੇਦਕਰ ਜੀ ਨੇ ਲਿਖਿਆ ਹੈ ਅਤੇ ਨਾਈਨਟੀਨ ਏਟੀ ਥਰੀ ਵਿੱਚ ਕਪਿਲ ਜੈਨ ਨੇ ਵਰਲਡ ਕੱਪ ਜਿੱਤ ਕੇ ਭਾਰਤ ਦੇ ਮਾਣ ਨੂੰ ਚਾਰ ਚੰਦ ਲਗਾ ਦਿੱਤੇ ਅਤੇ ਦੋ ਹਜ਼ਾਰ ਚੌਦ੍ਹਾਂ ਵਿੱਚ ਭਾਰਤ ਹੀ ਉਹ ਇਕੱਲਾ ਦੇਸ਼ ਸੀ ਜਿਸ ਨੇ ਮਾਰਸ ਵਿੱਚ ਸਭ ਤੋਂ ਪਹਿਲਾਂ ਆਪਣਾ ਇੱਕ ਕਦਮ ਰੱਖਿਆ ਜਿੱਥੇ ਭਾਰਤ ਵਿੱਚ ਇੰਨੇ ਮਾਣ ਵਾਲੀ ਗੱਲ ਹੈ ਉੱਥੇ ਇੱਕ ਦੂਸਰੇ ਪਾਸੇ ਬਹੁਤ ਹੀ ਦੁਰਘਟਨਾ ਵਾਲੀ ਗੱਲ ਵੀ ਹੈ ਲੈ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਸਾਰੇ ਬੱਚੇ ਬਜ਼ੁਰਗ ਅਤੇ ਮਾਤਾ ਪਿਤਾ ਇੱਕ ਦੂਜੇ ਤੋਂ ਵਿਛੜ ਗਏ ਜੋ ਕਿ ਹਜੇ ਤੱਕ ਵੀ ਇੱਕ ਦੂਜੇ ਨੂੰ ਨਹੀਂ ਮਿਲ ਪਾਏ ਆਜ਼ਾਦੀ ਦੀ ਲੜਾਈ ਨਾਈਨਟੀਨ ਫੋਰਟੀ ਸੈਵਨ ਦੇ ਵਿੱਚ ਹੋਈ ਸੀ ਅਤੇ ਇਸ ਆਜ਼ਾਦੀ ਦੇ ਦੌਰਾਨ ਬਹੁਤ ਸਾਰੇ ਲੋਕ ਮਾਰੇ ਵੀ ਗਏ ਜੀ ਹਾਂ ਅਤੇ ਸਾਡੇ ਭਾਰਤ ਵਿੱਚ ਕੁਛ ਬੇਮਿਸਾਲ ਨੇ ਨੇਤਾਵਾਂ ਦੇ ਨਾਂ ਹਨ ਜਿਵੇਂ ਕਿ ਜਿਵੇਂ ਕਿ ਲਾਲਾ ਲਾਜਪਤ ਰਾਇ ਮਹਾਤਮਾ ਗਾਂਧੀ ਜੀ